ਇੱਕ ਵਾਰੀ ਮੈਂ ਕੰਧ 'ਤੇ ਚਿੱਤਰਕਾਰੀ ਕਰਨ ਲੱਗਾ ਇਹ ਚਿੱਤਰਕਾਰੀ ਮੇਰੇ ਲਈ ਚੁਣੌਤੀਪੂਰਨ ਸੀ ਕਿਉਂਕਿ ਉਸ ਕੰਧ 'ਤੇ ਮੈਨੂੰ ਚਿੱਤਰਕਾਰੀ ਕਰਨ ਲਈ ਇੱਕ ਪੇੜ ਬਣਾਉਣਾ ਸੀ ਅਤੇ ਉਸ ਪੇੜ 'ਤੇ ਜਿਹੜੇ ਪੰਛੀ ਬਣਾਉਣੇ ਸੀ ਉਹ ਇਸ ਤਰ੍ਹਾਂ ਲੱਗਣੇ ਚਾਹੀਦੇ ਸੀ ਕਿ ਉਹ ਅਸਲੀਅਤ ਵਿੱਚ ਇੱਥੇ ਪੇੜ ਉੱਤੇ ਬੈਠੇ ਹਨ ਮਤਲਬ ਇਹ ਕਿ ਉਹ 'ਤੇ ਥ੍ਰੀ ਡੀ ਤਿੰਨ ਡਿਮੈਂਸ਼ਨਲ ਮੈਨੂੰ ਇੱਕ ਇਫੈਕਟ ਪਾਉਣਾ ਪੈਣਾ ਸੀਗਾ ਉਹ ਚਿੱਤਰਕਾਰੀ ਮੇਰੇ ਲਈ ਚੁਣੌਤੀਪੂਰਨ ਸੀ ਉਸ ਚਿੱਤਰਕਾਰੀ ਨੂੰ ਕਰਨ ਲਈ ਮੈਨੂੰ ਇੱਕ ਹਫਤੇ ਦੇ ਲਗਭਗ ਸਮਾਂ ਲੱਗ ਗਿਆ ਪਹਿਲਾਂ ਤਾਂ ਆਮ ਹੀ ਪੇੜ ਮੈਂ ਬਣਾ ਦਿੱਤਾ ਪਰ ਪੰਛੀ ਬਣਾਉਣ ਲਈ ਮੈਨੂੰ ਇੱਕ ਇੱਕ ਪੰਛੀ ਨੂੰ ਕਿੰਨਾ ਕਿੰਨਾ ਸਮਾਂ ਲਗਾਉਣਾ ਪੈਂਦਾ ਸੀ ਉਸ ਪੰਛੀ ਨੂੰ ਵੇਖ ਕੇ ਹੁਣ ਕੋਈ ਇਹ ਨਹੀਂ ਕਹਿ ਸਕਦਾ ਕਿ ਇਹ ਇੱਕ ਚਿੱਤਰਕਾਰੀ ਹੈ ਉਹ ਹਰ ਇੱਕ ਪੰਛੀ ਇੰਝ ਲੱਗਦਾ ਹੈ ਕਿ ਹੁਣੇ ਅੱਖ ਝਪਕਿਆਂ ਅਤੇ ਹੁਣੇ ਫੁਰ ਫੁਰ ਉੱਡਿਆ ਅਤੇ ਹੁਣੇ ਮੇਰੇ ਕੋਲ ਆ ਕੇ ਬੈਠਾ ਜਿਹੜਾ ਵੀ ਉਸ ਚਿੱਤਰਕਾਰੀ ਨੂੰ ਦੇਖਦਾ ਹੈ ਉਹ ਇਹੋ ਹੀ ਕਹਿੰਦਾ ਹੈ ਕਿ ਇਹ ਪੰਛੀ ਸਾਰੇ ਅਸਲੀ ਬੈਠੇ ਹੋਏ ਹਨ ਇੱਕ ਹਫਤੇ ਦੇ ਲਗਭਗ ਇੱਕ ਪੰਛੀ ਨੂੰ ਸਮਾਂ ਲੱਗਾ ਅਤੇ ਉਸ ਪੇੜ ਉੱਤੇ ਮੈਂ ਲਗਭਗ ਪੰਦਰਾਂ ਪੰਛੀ ਬਣਾਏ ਹੋਣੇ ਹਨ ਅਤੇ ਸੋਚੋ ਪੰ ਇੱਕ ਪੰਛੀ ਨੂੰ ਬਣਾਉਣ ਲਈ ਇੱਕ ਹਫਤਾ ਅਤੇ ਪੰਦਰਾਂ ਪੰਛੀ ਬਣਾਉਣ ਲਈ ਪੰਦਰਾਂ ਹਫਤੇ ਲੱਗ ਗਏ ਹੁਣ ਹਰ ਕੋਈ ਜਿਹੜਾ ਉਸ ਚਿੱਤਰਕਾਰੀ ਨੂੰ ਵੇਖਦਾ ਹੈ ਉਹ ਇਹੋ ਹੀ ਕਹਿੰਦਾ ਹੈ ਕਿ ਸਾਡੇ ਘਰ ਵੀ ਸਾਡੀ ਕੰਧ 'ਤੇ ਵੀ ਇਸ ਤਰ੍ਹਾਂ ਦੀ ਚਿੱਤਰਕਾਰੀ ਕਰੋ ਕਿ ਹਰ ਕੋਈ ਵੇਖ ਕੇ ਹੈਰਾਨ ਹੋ ਜਾਵੇ ਉਹ ਚਿੱਤਰਕਾਰੀ ਮੇਰੇ ਲਈ ਇੱਕ ਚੁਣੌਤੀਪੂਰਨ ਚਿੱਤਰਕਾਰੀ ਸੀ